ਮੇਰੇ ਪਿੰਡ ਦੀਆਂ ਔਰਤਾਂ ਇੱਕ ਦਿਨ ਰੱਖਦੀਆਂ ਹਨ ਅਤੇ ਫਿਰ ਇੱਕ ਘਰ ਜਾਂ ਕੋਈ ਵੀ ਜਗ੍ਹਾ ਜਿੱਥੇ ਉਹ ਇਕੱਠੀਆਂ ਹੋ ਕੇ ਬੈਠ ਸਕਣ ਉਹ ਨਿਸ਼ਚਿਤ ਕਰਦੀਆਂ ਹਨ ਫਿਰ ਜਦੋਂ ਉਹ ਦਿਨ ਜਾਂ ਉਹ ਸਮਾਂ ਆ ਜਾਂਦਾ ਹੈ ਤਾਂ ਉਹ ਆਪਣੇ ਹੱਥ ਵਿੱਚ ਮਿਰਚਾਂ ਵਾਲਾ ਕੋਈ ਵੀ ਬਰਤਨ ਲੈ ਕੇ ਇੱਕ ਦੂਜੀ ਨੂੰ ਘਰੋਂ ਆਵਾਜ਼ਾਂ ਮਾਰ ਮਾਰ ਬੁਲਾ ਕੇ ਲੈ ਕੇ ਆਉਂਦੀਆਂ ਹਨ ਅਤੇ ਉਸ ਜਗ੍ਹਾ 'ਤੇ ਇਕੱਠੀਆਂ ਹੋ ਜਾਂਦੀਆਂ ਹਨ ਜਿਹੜੀ ਉਹਨਾਂ ਨੇ ਨਿਸ਼ਚਿਤ ਕੀਤੀ ਹੁੰਦੀ ਹੈ ਫਿਰ ਜਿਵੇਂ ਦੋ ਜਣੀਆਂ ਦੀ ਟੋਲੀ ਜਾਂ ਚਾਰ ਜਣੀਆਂ ਦੀ ਟੋਲੀ ਇੱਕ ਔਖਲੀ ਕੋਲ ਖਲੋ ਜਾਂਦੀ ਹੈ ਅਤੇ ਇੱਕ ਜਣੀ ਕੋਈ ਵੀ ਮਸਾਲੇ ਜਾਂ ਮਿਰਚਾਂ ਨੂੰ ਔਖਲੀ ਵਿੱਚ ਪਾਉਂਦੀ ਹੈ ਅਤੇ ਦੂਸਰੀ ਜਣੀ ਉਸਨੂੰ ਕੁੱਟਣ ਜਾਂ ਪੀਸਣ ਲੱਗ ਜਾਂਦੀ ਹੈ ਇਸ ਤਰ੍ਹਾਂ ਉਸ ਜਗ੍ਹਾ ਉੱਪਰ ਤਿੰਨ ਚਾਰ ਔਖਲੀਆਂ ਕੋਲ ਤਿੰਨ ਚਾਰ ਔਰਤਾਂ ਦੀਆਂ ਟੋਲੀਆਂ ਖਲੋ ਜਾਂਦੀਆਂ ਹਨ ਅਤੇ ਉਹ ਵਾਰੀ ਵਾਰੀ ਆਪਣੇ ਮਸਾਲੇ ਜਾਂ ਮਿਰਚਾਂ ਪੀਸਣ ਲੱਗ ਜਾਂਦੀਆਂ ਹਨ ਅਤੇ ਇਸ ਦੌਰਾਨ ਉਹ ਇਕੱਲੀਆਂ ਮਿਰਚਾਂ ਹੀ ਨਹੀਂ ਪੀਸਦੀਆਂ ਸਗੋਂ ਕੋਈ ਉਹ ਚੁਗਲੀਆਂ ਜਾਂ ਆਪਸ ਦੀਆਂ ਗੱਲਾਂ ਬਾਤਾਂ ਜੋ ਇੰਨੇ ਟਾਈਮ ਬਾਅਦ ਇਕੱਠੀਆਂ ਹੋਣ 'ਤੇ ਕਰਦੀਆਂ ਹਨ ਅਤੇ ਉਹ ਉੱਥੇ ਪੂਰਾ ਰੰਗ ਬੰਨ੍ਹਦੀਆਂ ਹਨ ਅਤੇ ਨਾਲ ਹੀ ਆਪਣੇ ਘਰ ਦੇ ਕੰਮ ਕਾਜ ਵੀ ਕਰਦੀਆਂ ਹਨ